ਸਤਿ ਸ਼੍ਰੀ ਅਕਾਲ ਕੀ ਮੇਰੀ ਗੱਲ ਸੈਵਨ ਸਟਾਰ ਹੋਟਲ ਦੇ ਮੈਨੇਜਰ ਨਾਲ਼ ਹੋ ਰਹੀ ਹੈ ਮੈਂ ਆਪਣੇ ਰੀਲੇਟਿਵਜ਼ ਨੂੰ ਤੁਹਾਡੇ ਕੋਲ਼ ਸਟੇਅ ਕਰਵਾਈ ਸੀ ਤੁਹਾਡੇ ਹੋਟਲ 'ਚ ਅਤੇ ਮੈਨੂੰ ਤੁਹਾਡੀ ਸਰਵਿਸ ਬਹੁਤ ਵਧੀਆ ਲੱਗੀ ਤੁਸੀਂ ਮਤਲਬ ਟਾਈਮ ਟੂ ਟਾਈਮ ਉਹਨਾਂ ਨੂੰ ਖਾਣ ਲਈ ਵੀ ਵਧੀਆ ਦਿੱਤਾ ਸਭ ਕੁਝ ਅਤੇ ਰੂਮ ਦੀ ਸਰਵਿਸ ਬਿਲਕੁਲ ਵਧੀਆ ਸੀ ਤੁਹਾਡੇ ਰੂਮਜ਼ ਵੀ ਬਹੁਤ ਕਲੀਨ ਸੀਗੇ ਕੁਝ ਮੈਨੂੰ ਸਰਵਿਸ ਤੁਹਾਡੀ ਬਹੁਤ ਵਧੀਆ ਲੱਗੀ ਅਗਰ ਅੱਗੇ ਤੋਂ ਵੀ ਮੈਂ ਕਦੇ ਵੀ ਸਰਵਿਸ ਲੈਣੀ ਹੋਵੇਗੀ ਕਿਸੇ ਹੋਟਲ ਦੀ ਤਾਂ ਮੈਂ ਤੁਹਾਡਾ ਹੋਟਲ ਹੀ ਸੁਜੈਸਟ ਕਰਾਂਗੀ ਸਭ ਨੂੰ ਤੇ ਖੁਦ ਲਈ ਵੀ ਕੀ ਤੁਹਾਡੇ ਹੋਟਲ ਵਿੱਚ ਕੋਈ ਹੋਰ ਵੀ ਡਿਸਕਾਊਂਟਸ ਵੀ ਹਨ ਓਕੇ ਠੀਕ ਹੈ ਓਕੇ ਠੀਕ ਹੈ ਇਸ ਤੋਂ ਇਲਾਵਾ ਹੋਰ ਕੋਈ ਸਰਵਿਸ ਵੀ ਹੈ ਤੁਹਾਡੇ ਵੱਲੋਂ ਦਿੱਤੀ ਜਾਂਦੀ ਓਕੇ ਜੀ ਚਲੋ ਠੀਕ ਹੈ ਜੀ ਧੰਨਵਾਦ ਅੱਗੇ ਤੋਂ ਅਗਰ ਮੈਨੂੰ ਜ਼ਰੂਰਤ ਹੋਵੇਗੀ ਤਾਂ ਮੈਂ ਤੁਹਾਡੇ ਨਾਲ਼ ਕੋਨਟੈਕਟ ਕਰਾਂਗੀ